ਸਾਡੇ ਨਜ਼ਦੀਕ ਕਈ ਖੇਡ ਕੇਂਦਰ ਹਨ ਜਿਵੇਂ ਕਿ ਮਾਨਸਾ ਸਟੇਡੀਅਮ ਸਾਡੇ ਨੇੜੇ ਭੀਖੀ ਨੈਸ਼ਨਲ ਕਾਲਜ ਸਟੇਡੀਅਮ ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਖੇਡਦੇ ਹਨ ਭੱਜਦੇ ਹਨ ਦੌੜਦੇ ਹਨ ਹਾਕੀ ਕਬੱਡੀ ਆਦਿ ਖੇਡਾਂ ਖੇਡਦੇ ਹਨ ਜਿਵੇਂ ਕਿ ਕ੍ਰਿਕਟ ਫੁੱਟਬਾਲ ਬਾਸਕਿਟਬਾਲ ਬੱਚੇ ਬਹੁਤ ਖੇਡਦੇ ਹਨ ਸ਼ਾਮ ਨੂੰ ਗਰਾਉਂਡ ਬੱਚਿਆਂ ਨਾਲ ਬਹੁਤ ਭਰਿਆ ਹੁੰਦਾ ਹੈ ਅਤੇ ਉੱਥੇ ਬਹੁਤ ਬੱਚੇ ਖੇਡਣ ਲਈ ਤਿਆਰ ਹੁੰਦੇ ਹਨ ਜਿਵੇਂ ਕਿ ਸਾਡੇ ਭੀਖੀ ਵਿੱਚ ਕ੍ਰਿਕਟ ਦੇ ਖਿਡਾਰੀ ਬਹੁਤ ਦੂਰ ਦੂਰ ਤੱਕ ਗਏ ਹਨ ਅਤੇ ਇਹਨਾਂ ਵਿੱਚੋਂ ਕਈ ਬੱਚੇ ਨੈਸ਼ਨਲ ਸਟੇਟ ਪਲੇਅਰ ਵੀ ਹਨ ਕਈ ਬੱਚੇ ਫੁੱਟਬਾਲ ਹਾਕੀ ਵਿੱਚ ਅਤੇ ਬਸਕਿਟਬਾਲ ਵਿੱਚ ਵੀ ਬਹੁਤ ਅੱਵਲ ਰਹਿ ਚੁੱਕੇ ਹਨ ਅਤੇ ਉੱਥੇ ਬੱਚਿਆਂ ਦੇ ਰਹਿਣ ਖਾਣ ਪੀਣ ਲਈ ਵੀ ਕਾਲਜ ਸਕੂਲ ਪ੍ਰਬੰਧ ਕਰਦਾ ਹੈ ਖਿਡਾਰੀਆਂ ਨੂੰ ਉਤਸ਼ਾਹ ਵਧਾਉਂਦੇ ਹਨ ਤਾਂ ਜੋ ਖਿਡਾਰੀ ਅੱਗੇ ਵਧ ਸਕਣ ਅਤੇ ਨਸ਼ਿਆਂ ਤੋਂ ਮੁਕਤ ਹੋ ਸਕਣ ਅਤੇ ਅੱਗੇ ਵੱਲ ਵਧਣ ਹੋਰ ਨਵੀਂਆਂ ਤੋਂ ਨਵੀਆਂ ਖੇਡਾਂ ਸਿੱਖਣ ਅਤੇ ਮੈਡਲਾਂ ਦੀਆਂ ਪ੍ਰਾਪਤੀਆਂ ਕਰਨ